ਹਾਂਜੀ ਤਕਨਾਲੋਜੀ ਦੀ ਵਰਤੋਂ ਨੇ ਸੰਸਾਰ ਵਿੱਚ ਆਲ ਸਾਡੇ ਆਲੇ ਦੁਆਲੇ ਗੱਲਬਾਤ ਕਰਨ ਦੇ ਤਰੀਕੇ ਨੂੰ ਬਹੁਤ ਬਦਲ ਦਿੱਤਾ ਹੈ